ਸਤਿ ਸ਼੍ਰੀ ਅਕਾਲ ਜੀ ਮੈਂ ਅੱਜ ਤੁਹਾਡੇ ਵੱ ਤੁਹਾਡੇ ਤੋਂ ਇੱਕ ਭੋਜਨ ਦਾ ਆਰਡਰ ਬੁੱਕ ਕੀਤਾ ਸੀ ਜੋ ਕਿ ਸਾਡੇ ਅੱਜ ਮਹਿਮਾਨ ਨਹੀਂ ਆ ਰਹੇ ਸੋ ਬੇਨਤੀ ਹੈ ਕਿ ਜੋ ਮੈਂ ਆਰਡਰ ਬੁੱਕ ਕੀਤਾ ਸੀ ਉਸ ਨੂੰ ਰੱਦ ਕੀਤਾ ਜਾਵੇ ਔਰ ਜੋ ਮੇਰੇ ਪੈਸੇ ਹਨ ਉਹ ਮੈਨੂੰ ਰੀਫੰਡ ਕੀਤੇ ਜਾਣ ਧੰਨਵਾਦ ਜੀ